ਮੈਂ ਕਾਫੀ ਦਿਨ ਤੋਂ ਹੈੱਡਫੋਨ ਦੇਖ ਰਿਹਾ ਸੀ ਰੋਪੜ ਟ੍ਰਾਈ ਕੀਤੇ ਮੋਹਾਲੀ ਟ੍ਰਾਈ ਕੀਤੇ ਪਰ ਮੈਨੂੰ ਵਧੀਆ ਕੁਆਲਟੀ ਨਹੀਂ ਸੀ ਮਿਲਦੀ ਪਈ ਤਾਂ ਮੈਂ ਔਨਲਾਈਨ ਇੱਕ ਸਾਈਟ ਤੋਂ ਆਰਡਰ ਆਰਡਰ ਕੀਤੇ ਤਾਂ ਜਦੋਂ ਮੇਰੇ ਕੋਲ਼ ਡਿਲੀਵਰ ਹੋਏ ਤਾਂ ਉਸ ਦੀ ਪੈਕਿੰਗ ਬਹੁਤ ਵਧੀਆ ਸੀ ਤਾਂ ਫਿਰ ਵੀ ਮੇਰਾ ਮਨ ਐਵੇਂ ਸੀ ਕਿ ਇੰਨੇ ਪੈਸੇ ਲਾ ਤਾਂ ਦਿੱਤੇ ਮੈਂ ਹੋ ਸਕਦਾ ਕਿ ਵਿੱਚੋਂ ਖਰਾਬ ਨਾ ਹੋਣ ਪੈਕਿੰਗ ਤਾਂ ਬਹੁਤ ਵਧੀਆ ਸੀ ਪਰ ਜਦੋਂ ਯੂਜ਼ ਕੀਤੇ ਤਾਂ ਬਹੁਤ ਵਧੀਆ ਕੁਆਲਟੀ ਸੀ ਵੋਲੀਅੂਮ ਬਹੁਤ ਵਧੀਆ ਸੀ ਉਸਦੀ ਬਹੁਤ ਹੀ ਜ਼ਿਆਦਾ ਵਧੀਆ ਦਿੱਤੇ ਜਿਵੇਂ ਵੀ ਆਪਾਂ ਚੌਵੀ ਘੰਟੇ ਲਗਾ ਕੇ ਰੱਖਦੇ ਹਾਂ ਫਿਰ ਵੀ ਕੰਫਰਟੇਬਲ ਸੀ ਕੋਈ ਇਦਾਂ ਦਾ ਨਹੀਂ ਸੀ ਕਿ ਕੰਨ ਦੁੱਖ ਰਹੇ ਸਿਰ ਜੋ ਕੁਛ ਵੀ ਬਹੁਤ ਵਧੀਆ ਆਵਾਜ਼ ਸੀ ਉਹਨਾਂ ਦੀ ਕੁਆਲਟੀ ਤਾਂ ਬਹੁਤ ਵਧੀਆ ਸੀ ਹੈੱਡਫੋਨ